ਸੁਖਵੰਤ ਸਿੰਘ ਜੀ ਕੀ ਹਾਲ ਆ ਜੀ ਹੋਰ ਪਰਿਵਾਰ ਠੀਕ ਠਾਕ ਆ ਵੀਰ ਜੀ ਅਸੀਂ ਨਾ ਅੱਜ ਫਤਿਹਗੜ੍ਹ ਸਾਹਿਬ ਆਏ ਹੋਏ ਤੇ ਜੀ ਇੱਧਰ ਤੇ ਪਰਿਵਾਰ ਸਮੇਤ ਆਏ ਹੋਏ ਤੇ ਆਪ ਨੂੰ ਇੱਕ ਰਾਏ ਲੈਣੀ ਆ ਅਤੇ ਅਸੀਂ ਅੱਜ ਲੰਚ ਕਰ ਕਰਨਾ ਜੀ ਅਤੇ ਇਸ ਅਤੇ ਇਹ ਏਰੀਏ ਦੇ ਵਿੱਚ ਫਤਿਹਗੜ੍ਹ ਸਾਹਿਬ ਦੇ ਵਿੱਚ ਕਿਹੜਾ ਰੈਸਟੋਰੈਂਟ ਵਧੀਆ ਅਤੇ ਅਸੀਂ ਨੇ ਲੰਚ ਕਰਨਾ ਹੈ ਅਤੇ ਉੱਥੇ ਸਾਫ ਸੁਥਰਾ ਹੋਵੇ ਅਤੇ ਉਹਨਾਂ ਦਾ ਰੇਟਿੰਗ ਕੀ ਨੇ ਅਤੇ ਉਹ ਸਬਜ਼ੀਆਂ ਭਾਜੀਆਂ ਤਾਜ਼ੀਆਂ ਫਰੈਸ਼ ਨੇ ਜਾਂ ਕਿਵੇਂ ਨੇ ਅਤੇ ਉਹਨਾਂ ਦਾ ਸਟਾਫ ਕਿਹੋ ਜਿਹਾ ਸਭ ਕੁਛ ਮੈਨੂੰ ਦੱਸਦੇ ਵੀਰ ਬਣ ਕੇ ਕਿਹੜਾ ਸਹੀ ਹੈ ਇਹਨਾਂ ਵਿੱਚੋਂ